ਜਦੋਂ ਕੋਈ ਖਿਡਾਰੀ ਆਪਣੀ ਖੇਡ ਵਿੱਚ ਮਾਹਿਰ ਹਾਸਲ ਕਰ ਲੈਂਦਾ ਹੈ ਜਾਂ ਬਹੁਤ ਵਧੀਆ ਖੇਡਦਾ ਹੈ ਤਾਂ ਉਸ ਨੂੰ ਸਰਕਾਰ ਦੁਆਰਾ ਸਕੋਲਰਸ਼ਿਪ ਦਿੱਤੀ ਜਾਂਦੀ ਹੈ ਸਾਡੇ ਦੇਸ਼ ਸਾਡੇ ਪੰਜਾਬ ਵਿੱਚ ਵੀ ਐਦਾਂ ਦੀਆਂ ਬਹੁਤ ਸਾਰੀਆਂ ਖਿਡਾਰਨਾਂ ਅਤੇ ਖਿਡਾਰੀ ਹਨ ਜਿਨ੍ਹਾਂ ਨੂੰ ਕਿ ਸਕੋਲਰਸ਼ਿਪ ਦਿੱਤੀ ਜਾਂਦੀ ਹੈ ਪਰ ਇਸਦੀ ਇੱਕ ਹੀ ਸ਼ਰਤ ਹੁੰਦੀ ਹੈ ਕਿ ਸਾਨੂੰ ਆਪਣੇ ਦੇਸ਼ ਨੂੰ ਨੈਸ਼ਨਲ ਲੈਵਲ 'ਤੇ ਰੀਪ੍ਰਜੈਂਟ ਕਰਨਾ ਪੈਂਦਾ ਹੈ ਅਤੇ ਜਿਹੜਾ ਵਿਅਕਤੀ ਜਾਂ ਜਿਹੜਾ ਖਿਡਾਰੀ ਇਹ ਆਪਣੇ ਦੇਸ਼ ਨੂੰ ਨੈਸ਼ਨਲ ਲੈਵਲ 'ਤੇ ਰੀਪ੍ਰਜੈਂਟ ਕਰਦਾ ਹੈ ਅਤੇ ਜਿੱਤ ਹਾਸਲ ਕਰਦਾ ਹੈ ਤਾਂ ਉਸਨੂੰ ਆਪਣੇ ਘ ਖੇਤਰ ਵਿੱਚ ਆ ਕੇ ਸਕੋਲਰਸ਼ਿਪ ਜਾਂ ਸਰਕਾਰੀ ਨੌਕਰੀ ਦਿੱਤੀ ਜਾਂਦੀ ਹੈ ਸਾਡੇ ਪੰਜਾਬ ਵਿੱਚ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਖਿਡਾਰਨਾਂ ਅਤੇ ਖਿਡਾਰੀ ਹਨ ਜਿਨ੍ਹਾਂ ਨੂੰ ਕਿ ਸਰਕਾਰੀ ਨੌਕਰੀ ਦਿੱਤੀ ਗਈ ਹੈ ਜੋ ਕਿ ਉਹਨਾਂ ਨੂੰ ਖੇਡ ਦੀ ਸਕੋਲਰਸ਼ਿਪ ਕਰਕੇ ਹੀ ਮਿਲੀ ਹੋਈ ਹੈ